ਹੈਲੋ ਸਤਿ ਸ਼੍ਰੀ ਅਕਾਲ ਸਰ ਪੀਜ਼ਾ ਪਲੈਨਟ ਤੋਂ ਗੱਲ ਕਰ ਰਹੇ ਹੋ ਮੇਰਾ ਨਾਮ ਪੁਨੀਤ ਸ਼ਰਮਾ ਹੈ ਸਰ ਮੈਂ ਸ਼ਿਵ ਮੰਦਰ ਨੰਗਲ ਰੋਡ ਤੋਂ ਗੱਲ ਕਰ ਰਹੀ ਹਾਂ ਸਰ ਮੇਰਾ ਔਰਡਰ ਸੀ ਮੈਨੂੰ ਇੱਕ ਮੀਡੀਅਮ ਸਾਈਜ਼ ਪੀਜ਼ਾ ਚਾਹੀਦਾ ਹੈ ਅਤੇ ਦੋ ਬਰਗਰ ਚਾਹੀਦੇ ਹੈ ਸਰ ਜਿਹੜਾ ਮੇਰਾ ਪਟੀਕੁਲਰ ਅਡਰੈੱਸ ਹੈ ਉਹ ਵੈਸੇ ਤਾਂ ਸ਼ਿਵ ਮੰਦਰ ਹੈ ਪਰ ਜਦੋਂ ਤੁਸੀਂ ਆਪਣੇ ਕੈਫੇ ਦੇ ਵਿੱਚੋਂ ਨਿਕਲਦੇ ਹੋ ਤਾਂ ਉੱਥੇ ਤੋਂ ਤੁਸੀ ਸਿੱਧਾ ਬਾਹਰ ਨਿਕਲ ਕੇ ਜਿਹੜਾ ਤੁਹਾਨੂੰ ਨਵਾਂ ਪੁਲ ਪੈਂਦਾ ਹੈ ਸਭ ਤੋਂ ਪਹਿਲਾਂ ਉਹਨੂੰ ਕ੍ਰੌਸ ਕਰਕੇ ਉਸ ਤੋਂ ਬਾਅਦ ਤੁਸੀਂ ਸੱਜੇ ਪਾਸੇ ਨੂੰ ਆਉਣਾ ਹੈ ਸੱਜੇ ਪਾਸੇ ਨੂੰ ਆ ਕੇ ਥੋੜ੍ਹਾ ਜਿਹਾ ਅੱਗੇ ਫੇਰ ਫਾਟਕ ਹੈ ਫਾਟਕਾਂ ਤੋਂ ਸਰ ਸਿੱਧਾ ਦੋ ਰੋਡ ਆੳਂਦੇ ਹੈ ਦੋ ਰੋਡ ਦੇ ਵਿੱਚੋਂ ਤੁਸੀ ਸਰ ਸੱਜੇ ਨਹੀਂ ਚੜ੍ਹਨਾ ਤੁਸੀਂ ਖੱਬੇ ਚੜ੍ਹ ਜਾਣਾ ਹੈ ਖੱਬੇ ਰੋਡ ਜਦੋ ਤੁਸੀ ਸਿੱਧਾ ਸਿੱਧਾ ਆਉਂਗੇ ਤਾਂ ਉੱਥੇ ਰਸਤੇ ਦੇ ਵਿੱਚ ਸਭ ਤੋਂ ਫੇਮਸ ਡੌਕਟਰ ਹੈ ਜਿਹੜੀ ਡੈਨਟੈਸਟ ਹੈ ਲੌਂਗੀਆ ਡੌਕਟਰ ਸੁਣਿਆ ਹੋਣਾ ਉਹਦੇ ਬਾਰੇ ਸਰ ਉੱਥੇ ਤੋਂ ਤੁਸੀ ਪੰਜ ਸੌ ਕੁ ਮੀਟਰ ਹੋਰ ਅੱਗੇ ਆਉਣਾ ਹੈ ਪੰਜ ਸੌ ਕੁ ਮੀਟਰ ਜਦੋਂ ਤੁਸੀਂ ਆਉਂਗੇ ਤਾਂ ਉੱਥੇ ਇੱਕ ਸਦਰ ਥਾਣਾ ਹੈ ਸਦਰ ਥਾਣੇ ਦੇ ਸਾਹਮਣੇ ਹੀ ਗ੍ਰੀਨ ਏਵਨਿਊ ਕਲੋਨੀ ਹੈ ਗ੍ਰੀਨ ਏਵਨਿਊ ਕਲੋਨੀ ਤੋਂ ਥੋੜ੍ਹਾ ਜਿਹਾ ਹੰ ਸੌ ਕੁ ਮੀਟਰ ਹੋਰ ਅੱਗੇ ਜਾ ਕੇ ਇੱਕ ਸ਼ਿਵ ਮੰਦਰ ਹੈ ਸਾਹਮਣੇ ਮਤਲਬ ਮੰਦਰ ਦੇ ਉੱਪਰ ਇੱਕ ਸ਼ਿਵ ਜੀ ਦੀ ਮੂਰਤੀ ਬਣੀ ਹੈ ਬਸ ਉਹਦੇ ਬੈਕ ਸਾਈਡ 'ਤੇ ਜਿਹੜਾ ਫਾਈਵ ਏਟ ਟੂ ਵੰਨ ਹਾਊਸ ਨੰਬਰ ਹੈ ਹਾਊਸ ਨੰਬਰ ਹੈ ਅਤੇ ਉਹਦੇ 'ਤੇ ਨੇਮ ਪਲੇਟ ਜਿਹੜੀ ਅਸ਼ਵਨੀ ਕੁਮਾਰ ਸ਼ਰਮਾ ਦੀ ਲੱਗੀ ਵੀ ਹੈ ਬਸ ਤੁਸੀ ਉੱਥੇ ਆ ਕੇ ਔਰਡਰ ਜਿਹੜਾ ਹੈ ਪਲੇਸ ਕਰਨਾ ਹੈ ਸਰ ਇਹ ਔਰਡਰ ਥੋੜ੍ਹਾ ਪਲੀਸ ਜਲਦੀ ਕਰ ਦਿਓ ਕਿਉਂਕਿ ਮੇਰੇ ਘਰ ਗੈਸਟ ਆਉਣੇ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ